ਮੋਟਰਸਾਈਕਲ ਸਿੱਖਣ ਲੱਗਿਆਂ ਸਭ ਤੋਂ ਪਹਿਲੀ ਗੱਲ ਕਿ ਸਾਨੂੰ ਇਹਦੇ ਵੱਖ ਵੱਖ ਹਿੱਸਿਆਂ ਬਾਰੇ ਚੰਗੀ ਜਾਣਕਾਰੀ ਹੋਵੇ ਚਾਹੇ ਉਹ ਕਲੱਚ ਹੋਵੇ ਰੇਸ ਹੋਵੇ ਜਾਂ ਬ੍ਰੇਕ ਹੋਵੇ ਪੈਰ ਦੀ ਭਾਵੇਂ ਹੱਥ ਵਾਲੀ ਅਤੇ ਸਭ ਤੋਂ ਅਹਿਮ ਗੱਲ ਕਿ ਜਦੋਂ ਅਸੀਂ ਮੋਟਰ ਬਾਈਕ ਸਿੱਖਣੀ ਸ਼ੁਰੂ ਕਰਦੇ ਹਾਂ ਤਾਂ ਸਪੀਡ ਵੱਲ ਗਤੀ ਵੱਲ ਬਹੁਤ ਧਿਆਨ ਦੇਣਾ ਹੁੰਦਾ ਹੈ ਕਿਉਂਕਿ ਜੋ ਸਿਖਾਂਦਰੂ ਹੈ ਉਸਨੂੰ ਚਾਹੀਦਾ ਹੈ ਕਿ ਜੋ ਗਤੀ ਘੱਟ ਤੋਂ ਘੱਟ ਰੱਖੀ ਜਾਵੇ ਤਾਂ ਜੋ ਕਿਸੇ ਕਿਸਮ ਦਾ ਨੁਕਸਾਨ ਖੁਦ ਦਾ ਅਤੇ ਕਿਸੇ ਹੋਰ ਦਾ ਸੜਕ ਦੇ ਉੱਤੇ ਨਾ ਹੋਵੇ ਸੋ ਗਤੀ ਸੰਬੰਧੀ ਨਿਯਮਾਂ ਦੀ ਪਾਲਣਾ ਦੇ ਨਾਲ ਨਾਲ ਇਹ ਵੀ ਧਿਆਨ ਰੱਖਣਾ ਕਿ ਜੋ ਬਹੁਤ ਹੀ ਸਹਿਜ ਦੇ ਨਾਲ ਧੀਮੀ ਗਤੀ ਦੇ ਨਾਲ ਇਹ ਸਿੱਖਣ ਦੀ ਪ੍ਰਕਿਰਿਆ ਸਹਿਜ ਹੋ ਜਾਂਦੀ ਹੈ ਅਤੇ ਲੋੜ ਮੁਤਾਬਿਕ ਗਤੀ ਸੀਮਾ ਦੇ ਅੰਦਰ ਰਹਿੰਦਿਆਂ ਜੋ ਕੀ ਟਰੈਫਿਕ ਨਿਯਮਾਂ ਦੇ ਅਨੁਸਾਰ ਹਨ ਵੀ ਪਾਬੰਦੀ ਨਾਲ ਵਰਤੋਂ ਕੀਤੀ ਜਾਵੇ